ਅਸੀਂ ਆਪਣੇ ਘਰ ਦੇ ਆਲੇ ਦੁਆਲੇ ਦੇ ਇਲਾਕੇ ਨੂੰ ਸਾਫ਼ ਰੱਖਣੀ ਬਹੁਤ ਹੀ ਤਰ੍ਹਾਂ ਦੇ ਉਪਾਅ ਕਰਦੇ ਹਾਂ ਜਿਵੇਂ ਕਿ ਆਪਾਂ ਅ ਦੇਖਦੇ ਹਾਂ ਸਾਡੇ ਆਲੇ ਦੁਆਲੇ ਵਿੱਚ ਕੋਈ ਕੂੜਾ ਕਰਕਟ ਤਾਂ ਨਹੀਂ ਇੱਥੇ ਉੱਥੇ ਪਿਆ ਹੋਇਆ ਫਿਰ ਆਪਾਂ ਜਿਹੜੇ ਸਾਡੇ ਘਰ ਦੇ ਬੱਚੇ ਹੈ ਜਿਵੇਂ ਮੈਂ ਹੋ ਗਈ ਆਪਾਂ ਕੀ ਕਰਦੇ ਹਾਂ ਕਿ ਆਪਾਂ ਆਪਣੇ ਘਰ ਦੇ ਬਾਹਰ ਇੱਕ ਡਸਟਬਿਨ ਵੀ ਰੱਖਿਆ ਹੋਇਆ ਅਗਰ ਕੋਈ ਵੀ ਤਰ੍ਹਾਂ ਦਾ ਕੂੜਾ ਕਰਕਟ ਹੁੰਦਾ ਤਾਂ ਆਪਾਂ ਉਹ ਉਹਦੇ ਵਿੱਚ ਪਾ ਦਿੰਦੇ ਹਾਂ ਅਤੇ ਮੈਂ ਐੱਨ ਸੀ ਸੀ ਦੇ ਨਾਲ ਜੁੜੀ ਹੋਈ ਹਾਂ ਜੋ ਸਫਾਈ ਕੇਂਦਰ ਦੇ ਨਾਲ ਹੈ ਆਪਾਂ ਪੂਰਾ ਆਪਣੇ ਘਰ 'ਚ ਵਿੱਚ ਘਰ ਦੇ ਬਾਹਰ ਆਪਾਂ ਪੂਰਾ ਸਾਫ਼ ਸਫਾਈ ਦਾ ਧਿਆਨ ਰੱਖਦੇ ਹਾਂ ਅਗਰ ਆਪਾਂ ਸਾਫ਼ ਸਫਾਈ ਨਹੀਂ ਰੱਖਾਂਗੇ ਉਵੇਂ ਹੀ ਕੀਟਾਣੂ ਵਧਣਗੇ ਉੱਨੀਆਂ ਹੀ ਬਿਮਾਰੀਆਂ ਵਧਣਗੀਆਂ ਇਸ ਲਈ ਆਪਾਂ ਇਹ ਸ਼ੁਰੂ ਤੋਂ ਹੀ ਸੋਚ ਰੱਖਿਆ ਕਿ ਆਪਾਂ ਆਪਣੇ ਅ ਘਰ ਦੇ ਆਲੇ ਦੁਆਲੇ ਨੂੰ ਵੀ ਸਾਫ਼ ਰੱਖਣਾ ਅਤੇ ਆਪਣੇ ਘਰ ਦੀ ਵੀ ਸਫਾਈ ਪੂਰੀ ਤਰ੍ਹਾਂ ਕਰਨੀ ਹੈ ਅਤੇ ਸਾਡੇ ਗਲੀ ਵਿੱਚ ਜ ਜੋ ਸਾਡਾ ਮੁਹੱਲਾ ਹੈਗਾ ਉਹ ਸਾਰੇ ਆਪਸ ਵਿੱਚ ਜੁੜੇ ਹੋਏ ਹੈ ਉਹ ਪੂਰਾ ਧਿਆਨ ਰੱਖਦੇ ਹੈ ਕਿ ਜਿਹੜੇ ਪਾਲਤੂ ਕੁੱਤੇ ਹੈਗੇ ਆ ਉਹਨਾਂ ਲਈ ਅਲੱਗ ਉਹਨਾਂ ਨੇ ਇੱਕ ਗਲੀ ਵਿੱਚ ਹੀ ਮਕਾਨ ਬਣਾ ਕੇ ਰੱਖਿਆ ਹੋਇਆ ਉਹਨਾਂ ਦੀ ਸਾਫ਼ ਸਫਾਈ ਦਾ ਕਿ ਅਗਰ ਉਹ ਕਿਸੇ ਇਹ ਬੱਚੇ ਕੋਲ ਜਾਂਦਾ ਤਾਂ ਉਹਨੂੰ ਕੋਈ ਕੀਟਾਣੂ ਵਗੈਰਾ ਛੂਹਣਾ ਨਾ ਪੂਰੀ ਸਾਫ਼ ਸਫਾਈ ਦਾ ਖਿਆਲ ਰੱਖਿਆ ਜਾਂਦਾ ਹੈ ਅਤੇ ਸਾਰਿਆਂ ਨੂੰ ਦੱਸਿਆ ਜਾਂਦਾ ਹੈ ਕਿ ਬੱਚਿਆਂ ਨੂੰ ਸੀਖ ਦਿੱਤੀ ਜਾਂਦੀ ਹੈ ਕਿ ਕੂੜਾ ਕਰਕਟ ਕੂੜੇਦਾਨ ਵਿੱਚ ਹੀ ਪਾਉਣਾ ਐ ਬਾਹਰ ਕਿੱਥੇ ਇੱਥੇ ਉੱਥੇ ਨਹੀਂ ਸੁੱਟਣਾ ਕਿਉਂਕਿ ਬਹੁਤ ਸਾਰੀਆਂ ਬਿਮਾਰੀਆਂ ਹੁੰਦੀਆਂ ਹੈ ਜੋ ਫੈਲ ਜਾਂਦੀਆਂ ਅਤੇ ਆਪਾਂ ਪੂਰਾ ਇਹ ਇੱਕ ਤਰ੍ਹਾਂ ਦਾ ਇੱਕ ਮੈਮ ਟੀਮ ਮੈਂਬਰ ਬਣਾਇਆ ਹੋਇਆ ਜੋ ਸਾਡੇ ਅ ਪੂਰੇ ਮੁਹੱਲੇ ਦੀ ਸਾਫ਼ ਸਫਾਈ ਦਾ ਜੋ ਠੇਕਾ ਉਠਾਉਂਦਾ ਆ ਅਗਰ ਕੋਈ ਵੀ ਇਸ ਦੀ ਉਲੰਘਣਾ ਕਰਦਾ ਹੈ ਤਾਂ ਉਹਨਾਂ ਨੂੰ ਦੱਸਿਆ ਜਾਂਦਾ ਹੈ ਲੇਕਿਨ ਅ ਅੱਜ ਤੱਕ ਕਿਸੇ ਨੇ ਵੀ ਇੱਦਾਂ ਨਹੀਂ ਕਰਿਆ ਸਾਰੇ ਘਰ ਦੇ ਮੈਂਬਰ ਮੁਹੱਲੇ ਦੇ ਮੈਂਬਰ ਸਾਰੇ ਸਾਫ਼ ਸਫਾਈ ਦਾ ਬਹੁਤ ਹੀ ਜ਼ਿਆਦਾ ਧਿਆਨ ਰੱਖਦੇ ਹਨ ਕਿਉਂਕਿ ਅਗਰ ਆਪਾਂ ਸਾਫ਼ ਸਫਾਈ ਦਾ ਧਿਆਨ ਰੱਖਾਂਗੇ ਤਾਂ ਹੀ ਇਹ ਸਾਡੇ ਮੁਹੱਲੇ ਦੇ ਜਿੰਨੇ ਵੀ ਲੋਕ ਆ ਉਹ ਸਾਰੇ ਸਾਫ਼ ਸਫਾਈ ਦਾ ਧਿਆਨ ਰੱਖਣਗੇ